ਨਮਸਕਾਰ ਜੀ ਮੈਂ ਸੁਨੀਤਾ ਰਾਣੀ ਬੋਲ ਰਹੀ ਹਾਂ ਕੁਛ ਦਿਨ ਪਹਿਲਾਂ ਮੈਂ ਆਪਣਾ ਗੈ ਸਿਲੰਡਰ ਬੁੱਕ ਕਰਵਾਇਆ ਸੀ ਅਤੇ ਅੱਜ ਮੈਨੂੰ ਪਤਾ ਲੱਗਿਆ ਹੈ ਕੀ ਕੇ ਵਾਈ ਸੀ ਨਾ ਹੋਣ ਕਰ ਕੇ ਮੇਰੀ ਬੁਕਿੰਗ ਨਹੀਂ ਹੋਈ ਮੇਰਾ ਬੁਕਿੰਗ ਨੰਬਰ ਪੰਜ ਸੱਤ ਚਾਰ ਤਿੰਨ ਦੋ ਅਤੇ ਆਧਾਰ ਕਾਰਡ ਨੰਬਰ ਇੱਕ ਪੰਜ ਛੇ ਸੱਤ ਅੱਠ ਨੌਂ ਚਾਰ ਤਿੰਨ ਦੋ ਛੇ ਹੈ ਮੇਰੀ ਕੇ ਵਾਈ ਸੀ ਪੂਰੀ ਕੀਤੀ ਜਾਵੇ ਮੈਨੂੰ ਇਹ ਦੱਸਿਆ ਜਾਵੇ ਕਿ ਸਿਲੰਡਰ ਦੀ ਡਿਲੀਵਰੀ ਕਦੋਂ ਤੱਕ ਹੋ ਜਾਵੇਗੀ